ਹੈਲੋ ਹੈਲੋ ਕਿਵੇਂ ਹੋ ਕੀ ਗੱਲ ਹੋ ਗਈ ਕੀ ਹੋ ਗਿਆ ਪਾਣੀ ਦੀ ਦਿੱਕਤ ਕੀ ਦਿੱਕਤ ਹੋ ਗਈ ਹਾਂ ਹਾਂ ਪਾਣੀ ਤਾਂ ਸੱਚੀ ਬਹੁਤ ਹੀ ਗੰਦਾ ਆਉਂਦਾ ਸਾਡੇ ਵੀ ਐਡਾ ਗੰਦਾ ਪਾਣੀ ਆਉਂਦਾ ਜੇ ਅਸੀਂ ਨਾ ਟੂਟੀ ਤੋਂ ਸਿੱਧੀ ਬਾਲਟੀ ਭਰਦੇ ਹਾਂ ਨਾ ਤਾਂ ਮਤਲਬ ਇੰਨਾ ਗੰਦਾ ਪਾਣੀ ਹੁੰਦਾ ਵੀ ਦੇਖਣ ਨੂੰ ਵੀ ਜੀਅ ਨਹੀ ਕਰਦਾ ਹੋਰ ਸਾਡੇ ਵੀ ਵਾਟਰ ਵਰਕਸ ਇਹੀ ਬੋ ਹਾਲ ਆ ਬਹੁਤ ਗੰਦਾ ਪਾਣੀ ਆਉਂਦਾ ਪਤਾ ਪਾਣੀ ਦੇ ਵਿੱਚੋਂ ਸਮੈਲ ਆਉਂਦੀ ਹੁੰਦੀ ਹੈ ਸਾਡੇ ਵੀ ਇਹੀ ਹਾਲਤ ਹੈ ਡਿੱਗੀਆਂ ਢਕੀਆਂ ਨਹੀਂ ਹੋਈਆਂ ਅਤੇ ਜਿਹੜਾ ਮਤਲਬ ਕੋਈ ਫਿਲਟਰ ਦਾ ਕੋਈ ਸਿਸਟਮ ਨਹੀਂ ਹੈਗਾ ਵਾਟਰ ਵਰਕਸ ਦੇ ਵਿੱਚ ਓ ਹੋ ਸਾਡੇ ਤਾਂ ਨਹਿਰ ਵਾਲਾ ਸਿੱਧਾ ਪਾਣੀ ਵਾਟਰ ਵਰਕਸ ਦੇ ਵਿੱਚ ਜਾਂਦਾ ਕੋਈ ਸਫਾਈ ਨਹੀਂ ਕੋਈ ਕੁਛ ਨਹੀਂ ਜੇ ਕੋਈ ਜਾਨਵਰ ਮਰਿਆ ਪਿਆ ਤਾਂ ਸਿੱਧਾ ਡਿੱਗੀ ਡਿੱਗੀਆਂ ਦੇ ਵਿੱਚ ਜਾ ਕੇ ਡਿੱਗੇਗਾ ਅਤੇ ਜੇ ਕੋਈ ਹੋਰ ਗੰਦ ਪਾਣੀ ਜਿਵੇਂ ਸਾਡੇ ਪਿੰਡ ਵਾਲੇ ਕੀ ਕਰਦੇ ਆ ਕਿ ਘਰ ਕੋਈ ਮੰਦਰ ਦਾ ਸਮਾਨ ਹੈ ਉਹ ਵੀ ਪਾਣੀ 'ਚ ਤੈਰਾ ਦਿੱਤਾ ਜੇ ਕੋਈ ਹੋਰ ਸਮਾਨ ਹੈ ਉਹ ਵੀ ਪਾਣੀ 'ਚ ਤੈਰਾ ਦਿੱਤਾ ਅਤੇ ਪਾਣੀ ਇੱਦਾਂ ਦੀ ਇੱਦਾਂ ਵਾਟਰ ਵਰਕਸ 'ਚ ਅਤੇ 'ਚੋਂ ਇੱਦਾਂ ਦੀ ਇੱਦਾਂ ਘਰੇ ਆ ਜਾਂਦਾ ਹਾਂ ਅਸੀਂ ਬਹੁਤ ਵਾਰੀ ਨਾ ਉਹ ਵੀ ਕੰਪਲੇਂਟ ਵੀ ਕਰ ਚੁੱਕੀ ਹਾਂ ਵੀ ਨਾ ਇਹਨਾਂ ਨੂੰ ਢੱਕ ਕੇ ਰੱਖਿਆ ਕਰੋ ਵੀ ਸਰਪੰਚ ਸਾਹਿਬ ਜੀ ਨੂੰ ਕਿਹਾ ਸੀ ਵੀ ਤੁਸੀਂ ਇਹਨਾਂ ਨੂੰ ਕਹੋ ਢੱਕ ਕੇ ਰੱਖੇ ਵਟਰ ਟੈਂਕੀ ਉੱਪਰ ਮਤਲਭ ਕਵਰ ਲਗਾ ਦੇਣ ਵੀ ਜਿਹੜੀਆਂ ਡਿ ਡਿੱਗੀਆ ਉਹ ਵੱਡੀਆ ਖੁੱਲ੍ਹੀਆਂ ਪਈਆ ਇੱਕ ਤਾਂ ਉਹ ਵੈਸੇ ਵੀ ਉਈਂ ਜ਼ਿਆਦਾ ਡਰਦੇ ਡਰ ਵੀ ਡਰ ਹੀ ਹੈਗਾ ਵੀ ਕੋਈ ਵਿੱਚ ਡਿੱਗ ਨਾ ਜਾਵੇ ਅਤੇ ਫਿਰ ਕੀ ਹੈ ਕੋਈ ਕੁੱਤਾ ਕਾਤਾ ਪਿ ਪਿੰਡ ਦਾ ਚਾਹੁੰਦਾ ਉੱਥੇ ਹੀ ਤੁਹਾਨੂੰ ਪਤਾ ਉਹਨਾਂ ਨੂੰ ਜਾਨਵਰ ਉਹਨਾਂ ਨੂੰ ਥੋੜ੍ਹੀ ਪਤਾ

ਅਤੇ ਪਾਣੀ ਫਿਰ ਬਦਲਦੇ ਵੀ ਨਹੀਂ ਉਹ ਪਾਣੀ ਉਦਾਂ ਹੀ ਚਲਦਾ ਰਹਿੰਦਾ ਚਲਦਾ ਜੇ ਕੋਈ ਜਾਨਵਰ ਡਿੱਗਿਆ ਪਿਆ ਐਵੇਂ ਨਹੀਂ ਕੱਢ ਕੇ ਵੀ ਪਾਣੀ ਬਦਲ ਦਈਏ ਨਾ ਉਹੀ ਘਰਾਂ 'ਚ ਛੱਡ ਦਿੰਦੇ ਆ ਚਲੋ ਕੋਈ ਗੱਲ ਨਹੀਂ ਤੁਸੀਂ ਨਾ ਐਵੇਂ ਕਰੋ ਦਵਾਈ ਲਓ ਅਤੇ ਵਧੀਆ ਰੈਸਟ ਕਰੋ ਆਪਣੀ ਹਾਂਜੀ ਓਕੇ ਹੋਰ ਚਲੋ ਠੀਕ ਹੈ ਜੀ